ਤਿੰਨ ਮਈ ਉੱਨੀ ਅਠਾਸੀ ਸੋਲਾਂ ਮਾਰਚ ਉੱਨੀ ਅੱਸੀ ਬਾਈ ਅਪ੍ਰੈਲ ਵੀਹ ਬਾਈ ਉੱਨੀ ਸਤੰਬਰ ਵੀਹ ਅਠਾਰਾਂ ਤੀਹ ਅਕਤੂਬਰ ਵੀਹ ਵੀਹ